ਸਿੱਖ ਧਰਮ ਦੁਨੀਆਂ ਦੇ ਸਭ ਤੋਂ ਮੋਡਰਨ ਅਤੇ ਲੇਟੈਸਟ ਧਰਮਾਂ ਵਿੱਚੋਂ ਇੱਕ ਹੈ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਨ ਜਿਸ ਬਾਣੀ ਗੁਰੂ ਜਿਸ ਨੂੰ ਗੁਰੂ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼੍ਰੀ ਦਸਮ ਗ੍ਰੰਥ ਜੀ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਗ੍ਰੰਥ ਹੈ ਇਹ ਵੀ ਸਿੱਖ ਧਰਮ ਦਾ ਇੱਕ ਮੁੱਢਲਾ ਗ੍ਰੰਥ ਹੈ ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਕਈ ਚਿੰਨ੍ਹ ਜਿਵੇਂ ਕਿ ਖੰਡਾ ਨਿਸ਼ਾਨ ਸਾਹਿਬ ਜੋ ਕਿ ਹਰ ਗੁਰਦੁਆਰਾ ਸਾਹਿਬ ਉੱਤੇ ਝੂਲਦਾ ਨਜ਼ਰ ਆਉਂਦਾ ਹੈ ਪੰਜ ਕਕਾਰ ਆਦਿ ਸਿੱਖ ਧਰਮ ਦੇ ਮੁੱਖ ਚਿੰਨ੍ਹ ਹਨ